ਹਾਂਜੀ ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਜਿੱਦਾਂ ਕਿ ਤੁਸੀਂ ਪੁੱਛਿਆ ਸਰੀਰਕ ਕਸਰਤ 'ਤੇ ਯੋਗਾ ਵਿੱਚ ਕੀ ਅੰਤਰ ਹੈ ਇੱਦਾਂ ਜਿਹੜੀ ਸਾਡੀ ਸਰੀਰਕ ਕਸਰਤ ਹੈ ਉਹ ਸਾਡੇ ਸਰੀਰ ਨੂੰ ਚੁਸਤ ਫੁਸਤ ਰੱਖਦੀ ਹੈ ਸਟੈਚਿੰਗ ਵਗੈਰਾ ਜਦੋਂ ਅਸੀਂ ਕਰਦੇ ਹਾਂ ਸਰੀਰ ਨੂੰ ਐਕਟਿਵ ਰੱਖਦੀ ਹੈ ਅਤੇ ਤੰਦਰੁਸਤ ਰੱਖਦੀ ਹੈ ਅਤੇ ਜਿਹੜਾ ਯੋਗਾ ਆ ਉਹ ਸਾਡੇ ਅੰਦਰੂਨੀ ਬਿਮਾਰੀਆਂ ਨੂੰ ਦੂਰ ਕਰਦਾ ਆ ਅਤੇ ਜਿਹੜੇ ਯੋਗਾ ਆ ਉਹ ਸਾਨੂੰ ਅਸੀਂ ਬਿਨਾਂ ਸਿੱਖੇ ਨਹੀਂ ਕਰ ਸਕਦੇ ਉਹ ਸਾਨੂੰ ਮੈਟ 'ਤੇ ਬਹਿ ਕੇ ਕਰਨਾ ਪੈਂਦਾ ਆ ਕਿ ਸਿੱਖਣਾ ਪੈਂਦਾ ਆ ਇਸ ਟੀਚਰ ਤੋਂ ਕਿਸੇ ਅਧਿਆਪਕ ਤੋਂ ਅਤੇ ਜਿਹੜੀ ਐਕਸਰਸਾਈਜ਼ ਆ ਉਹ ਤਾਂ ਚਲੋ ਅਸੀਂ ਘਰ ਕਰ ਸਕਦੇ ਹਾਂ ਲੱਤਾਂ ਬਾਵਾਂ ਦੀ ਤੁਰ ਫਿਰ ਕੇ ਇੱਧਰ ਉੱਧਰ ਥੋੜ੍ਹਾ ਬਹੁਤਾ ਸਟਿੱਚ ਕਰਕੇ ਅਤੇ ਜਿਹੜਾ ਯੋਗਾ ਆ ਉਹ ਸਾਨੂੰ ਸਿੱਖਣਾ ਪੈਂਦਾ ਉਹਦੀਆਂ ਕਲਾਸਾਂ ਲਾਉਣੀਆਂ ਪੈਂਦੀਆਂ ਨੇ ਯੋਗਾ ਜਿਹੜਾ ਆ ਉਹ ਸਾਡੇ ਅੰਦਰੂਨੀ ਬਿਮਾਰੀਆਂ ਨੂੰ ਦੂਰ ਕਰਦਾ ਆ ਅਤੇ ਅੰਦਰੋਂ ਤਾਂ ਤੰਦਰੁਸਤ ਰੱਖਦਾ ਆ ਅਤੇ ਜਿਹੜੀ ਕਸਰਤ ਆ ਉਹ ਸਾਡੇ ਸਰੀਰ ਨੂੰ ਚੁਸਤ ਫੁਰਤ ਰੱਖਦੀ ਹੈ ਅਤੇ ਐਕਟਿਵ ਰੱਖਦੀ ਹੈ ਬੋਡੀ ਨੂੰ